ਅੱਜ ਕੱਲ੍ਹ ਬਹੁਤ ਸਾਰੇ ਸਾਇੰਸ ਫੇਅਰਸ ਅਤੇ ਜਿਹੜੇ ਐਗਜੀਬਿਸ਼ਨ ਲੱਗ ਰਹੇ ਨੇ ਇਹਨਾਂ ਨਾਲ ਕੀ ਹੋ ਰਿਹਾ ਕਿ ਜਿਹੜੇ ਆਪਣੇ ਬੱਚੇ ਆ ਠੀਕ ਆ ਉਹ ਕੀ ਆ ਉਹਨਾਂ ਨੂੰ ਬਹੁਤ ਸਾਰੀ ਅਲੱਗ ਅਲੱਗ ਚੀਜ਼ਾਂ ਬਾਰੇ ਪਤਾ ਲੱਗ ਰਿਹਾ ਜਿਸ ਕਰਕੇ ਕੀ ਉਹਨਾਂ ਨੂੰ ਇਹ ਵੀ ਪਤਾ ਲੱਗ ਰਿਹਾ ਕਿ ਸਾਨੂੰ ਹੁਣ ਕਿਹੜੀ ਕਿਹੜੀ ਨਵੀਂ ਟੈਕਨੋਲੋਜੀ ਵਰਤਣੀ ਚਾਹੀਦੀ ਹੈ ਅਤੇ ਕਿਹੜੀ ਚੀਜ਼ਾਂ ਨੂੰ ਅਸੀਂ ਅਪਣਾ ਸਕਦੇ ਹਾਂ ਸਟੇਟ ਸੈਕਟਰ ਜਿਹੜੀ ਆ ਠੀਕ ਆ ਉਹਨਾਂ ਨੇ ਕੀ ਕੀਤਾ ਕੀ ਨਿਊ ਟੈਕਨੋਲੋਜੀ ਲਿਆ ਕੇ ਆਪਣੀ ਹੁਣ ਮਾਡਰਨ ਟੈਕਨੋਲੋਜੀ ਨਾਲ ਕੀ ਕੀਤਾ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਏ ਆ ਜਿਸ ਨਾਲ ਕੀ ਹੋ ਸਕੇ ਸਾਡੇ ਜਿਹੜੇ ਬੱਚੇ ਆ ਉਹ ਅੱਗੇ ਵੱਧ ਸਕਣ